ਪੰਜਾਬ ਵਿੱਚ ਨਾਗਰਿਕ ਸਿਆਸੀ ਚੋਣ ਆਪਣਾ ਇੰਟਰਸਟ ਜੋ ਹੈ ਉਹ ਇੱਕ ਵਿਚਾਰਧਾਰਾ ਦੇਖ ਕੇ ਲੈਂਦੇ ਹਨ ਜਿਹੜੀ ਵੀ ਸਿਆਸੀ ਪਾਰਟੀ ਦੀ ਉਹਨਾਂ ਨੂੰ ਸੋਚ ਚੰਗੀ ਲੱਗੇ ਉਸ ਵਿੱਚ ਉਹ ਭਾਗ ਲੈਂਦੇ ਹਨ